ਸਲਵਾਰਾਂ ਦੀਆਂ ਮੋਰੀਆਂ ਦੇ ਅਲੱਗ ਅਲੱਗ ਡਿਜ਼ਾਇਨ ਕਿਹੜੇ ਹਨ ਹਾਂਜੀ ਡਿਜ਼ਾਇਨ ਤਾਂ ਬਹੁਤ ਜ਼ਿਆਦਾ ਹਨ ਹੁਣ ਮਤਲਬ ਅੱਜ ਕੱਲ੍ਹ ਟਰੈਂਡ ਚੱਲ ਰਿਹਾ ਇਹ ਲਾਈਨ ਜਿੱਦਾਂ ਚੱਲਦੀਆਂ ਨੇ ਸਲਵਾਰਾਂ ਅਫਗਾਨੀ ਸਲਵਾਰਾਂ ਚੱਲਦੀਆਂ ਉਹਨਾਂ ਦੀਆਂ ਮੂਰੀਆਂ 'ਤੇ ਡਿਜ਼ਾਇਨ ਕਾਫੀ ਵਧੀਆ ਸੁੰਦਰ ਬਣਨ ਲੱਗ ਗਏ ਹਨ ਜਿੱਦਾਂ ਕੱਟ ਵਰਕ ਵਾਲੀਆਂ ਹੋ ਗਈਆਂ ਚਾਹੇ ਆਪਾਂ ਲੈਸ ਲਗਵਾ ਲਈਏ ਚਾਹੇ ਆਪਾਂ ਪਾਈਪਿੰਗ ਲਗਾ ਲਈਏ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਹਨ ਲੈਸ ਵਾਲੀ ਤਾਂ ਬਹੁਤ ਜ਼ਿਆਦਾ ਅੱਜ ਕੱਲ੍ਹ ਟਰੈਂਡ ਵਿੱਚ ਆ ਜਿੱਦਾਂ ਤਿੰਨ ਤਿੰਨ ਲੈਸ ਲਗਾ ਕੇ ਮਤਲਬ ਮੋਰੀ ਨੂੰ ਬਹੁਤ ਜ਼ਿਆਦਾ ਸੁੰਦਰ ਬਣਾਇਆ ਜਾਂਦਾ ਵੈਸੇ ਤਾਂ ਮਤਲਬ ਪਾਈਪਿੰਗ ਵਾਲੀ ਵੀ ਵਧੀਆ ਬਣਦੀ ਆ ਪਰ ਲੈਸ ਵਾਲੀ ਉਸ ਤੋਂ ਵੀ ਜ਼ਿਆਦਾ ਵਧੀਆ ਲੱਗਦੀ ਆ ਅਤੇ ਮੈਨੂੰ ਵੈਸੇ ਕੱਟ ਵਰਕ ਵਾਲੀ ਮੂਰੀ ਜ਼ਿਆਦਾ ਪਸੰਦ ਆ